ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਤਰਨਦੀਪ ਕੌਰ ਮਿਊਜ਼ਿਕ ਜਿਹੜੀ ਅਕੈਡਮੀ ਚਲਾਉਂਦੇ ਉੱਥੋਂ ਗੱਲ ਕਰ ਰਹੇ ਹੋ ਜੀ ਅੱਛਾ ਜੀ ਮੈਂ ਜੀ ਹਰਸ਼ਦੀਪ ਬੋਲ ਰਿਹਾ ਅਸੀਂ ਨਾ ਜੀ ਹੁਣੇ ਹੁਣੇ ਮੁੰਬਈ ਤੋਂ ਪੰਜਾਬ ਸ਼ਿਫਟ ਹੋਏ ਹਾਂ ਪਟਿਆਲੇ ਅਤੇ ਮੈਂ ਪੰਜਾਬ ਦੇ ਜਿਹੜੇ ਮਸ਼ਹੂਰ ਸਿੰਗਰ ਨੇ ਜਾਂ ਮਸ਼ਹੂਰ ਜਿਹੜੇ ਸੰਗੀਤਕਾਰ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਲੈਣੀ ਸੀ ਜੀ ਅੱਛਾ ਜੀ ਹਾਂਜੀ ਜੀ ਜੀ ਜੀ ਜੀ ਜੀ ਜੀ ਅੱਛਾ ਜੀ ਹਾਂਜੀ ਅਤੇ ਜੇਕਰ ਅਸੀਂ ਇੰਸਟਰੂਮੈਂਟ ਲੈਣੇ ਹੋਣ ਤਾਂ ਜੀ ਕਿੱਥੋਂ ਦੀ ਲੈ ਸਕਦੇ ਹਾਂ ਜਿਵੇਂ ਤਬਲਾ ਹੋ ਗਿਆ ਗਿਟਾਰ ਹੋ ਗਿਆ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਅਸੀਂ ਅਸੀਂ ਅਸੀਂ ਆਪਣੇ ਬੱਚੇ ਨੂੰ ਇੱਕ ਮਿਊਜ਼ਿਕ ਅਕੈਡਮੀ 'ਚ ਪਾਉਣਾ ਚਾਹੁੰਦੇ ਹਾਂ ਜੀ ਤਾਂ ਅਸੀਂ ਪੁੱਛਣਾ ਚਾ ਸੀਗਾ ਤੁਹਾਡੇ ਤੋਂ ਕਿ ਜੇ ਤੁਹਾਨੂੰ ਕੋਈ ਪਤਾ ਵਧੀਆ ਅਕੈਡਮੀ ਪਟਿਆਲੇ ਸ਼ਹਿਰ 'ਚ ਤਾਂ ਦੱਸ ਦਿੰਦੇ ਅੱਛਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਫਿਰ ਮੈਂ ਤੁਹਾਨੂੰ ਦੱਸਦਾ ਜੀ ਅੱਛਾ ਜੀ ਅੱਛਾ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ